ਪੰਜਾਬ ਵਿੱਚ ਬਹੁਤ ਸਾਰੀਆਂ ਘੁੰਮਣ ਫਿਰਨ ਨੂੰ ਥਾਵਾਂ ਹਨ ਜਿਵੇਂ ਕਿ ਮੈਂ ਪੰਜਾਬ ਵਿੱਚ ਰਹਿੰਦੀ ਹਾਂ ਮੈਂ ਪਟਿਆਲਾ ਸ਼ਹਿਰ 'ਚ ਰਹਿੰਦੀ ਹਾਂ ਅਤੇ ਜਿਵੇਂ ਕਿ ਪਟਿਆਲੇ ਸ਼ਹਿਰ ਵਿੱਚ ਕਾਲੀ ਮਾਤਾ ਦਾ ਮੰਦਰ ਆ ਦੂਖਨਿਵਾਰਨ ਸਾਹਿਬ ਆ ਜਿੱਥੇ ਨੌਵੇਂ ਪਾਤਸ਼ਾਹ ਜੀ ਆਏ ਹੈ ਬਹਾਦਰਗੜ੍ਹ ਸਾਹਿਬ ਆ ਉੱਥੇ ਨੌਵੇਂ ਪਾਤਸ਼ਾਹ ਜੀ ਆਏ ਹੈ ਮੋਤੀ ਬਾਗ ਸਾਹਿਬ ਹੈ ਓਥੇ ਨੌਵੇਂ ਪਾਤਸ਼ਾਹ ਜੀ ਆਏ ਵੇ ਹੈ ਜਿਵੇਂ ਕਿ ਕਿਲ੍ਹਾ ਚੌਕ ਹੈ ਉੱਥੇ ਬਾਬੇ ਆਲੀ ਦੀ ਜੋਤ ਜੱਗਦੀ ਹੈ ਜਦੋਂ ਜੋਤ ਬੁੱਝ ਗਈ ਪਟਿਆਲਾ ਸ਼ਹਿਰ ਉਸੀ ਟਾਈਮ ਖ਼ਤਮ ਹੋ ਜਾਏਗਾ ਉਸ ਤੋਂ ਬਾਆਦ 'ਚੋਂ ਜੀ ਬੜੀ ਨਦੀ ਹੈ ਜਦੋਂ ਇਹ ਚੜ੍ਹ ਕੇ ਆਉਂਦੀ ਹੈ ਤਾਂ ਰਾਜੇ ਮਹਾਰਾਜੇ ਇਸ ਨੱਥ ਚੁਲਾ ਦੇ ਕੇ ਸ਼ਾਂਤ ਕਰਦੇ ਹਨ ਅਤੇ ਫਿਰ ਅਨੰਦਪੁਰ ਸਾਹਿਬ ਆ ਗਿਆ ਉੱਥੇ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਸ਼ ਪਾਨ ਕਰਵਾ ਕੇ ਸਿੱਖੀ ਨੂੰ ਮਜ਼ਬੂਤ ਕੀਤਾ ਅਤੇ ਅਜੂਬਾ ਘਰ ਵੀ ਹੈ ਅਨੰਦ ਅੰਮ੍ਰਿਤਸਰ ਹੈ ਗੋਲਡਨ ਟੈਂਪਲ ਹੈ ਅਤੇ ਦੁਰਗਿਆਣਾ ਮੰਦਰ ਹੈ ਜਲ੍ਹਿਆਂਵਾਲਾ ਬਾਗ਼ ਹੈ ਵਾਹਗਾ ਬੋਰਡਰ ਹੈ

ਅਤੇ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਕਿ ਮੈਂ ਇਸ ਪੰਜਾਬ ਵਿੱਚ ਰਹਿੰਦੀ ਹਾਂ